ਮੈਂ ਇੱਕ ਗਾਇਕ ਹੋਣ ਦੇ ਨਾਤੇ ਰੋਜ਼ਾਨਾ ਸਵੇਰੇ ਅਤੇ ਸ਼ਾਮ ਦੋ ਤੋਂ ਢਾਈ ਘੰਟੇ ਤੱਕ ਰਿਆਜ਼ ਕਰਦਾ ਹਾਂ ਰਿਆਜ਼ ਦੇ ਵਿੱਚ ਮੈਂ ਜ਼ਿਆਦਾਤਰ ਤਾਂ ਹਾਰਮੋਨੀਅਮ ਨਾਲ ਕਰਦਾ ਹਾਂ ਇਸ ਤੋਂ ਇਲਾਵਾ ਮੈਂ ਰਵਾਬ ਢੋਲ ਢੱਡ ਸਰੰਗੀ ਚਿਮਟਾ ਵਗੈਰਾ ਅਤੇ ਜਿਹੜੀ ਵੀ ਨਵੀਂ ਤਕਨੀਕ ਨਿਵੇਕਲੀ ਕੋਈ ਆਉਂਦੀ ਆ ਮੈਂ ਉਹਨੂੰ ਸਿੱਖਣ ਦਾ ਚਾਹਵਾਨ ਰਹਿੰਦਾ ਹਾਂ ਜਿਸ ਤਰ੍ਹਾਂ ਮੈਂ ਕਈ ਧਾਰਮਿਕ ਪ੍ਰੋਗਰਾਮਾਂ ਦੇ ਵਿੱਚ ਜਾਂਦਾ ਹਾਂ ਉੱਥੇ ਮੈਨੂੰ ਢੱਢ ਸਰੰਗੀ ਜਿਹੜੀ ਆ ਉਹਦੀ ਬਹੁਤ ਜ਼ਰੂਰਤ ਪੈਂਦੀ ਆ ਮੈਂ ਉਸ ਦਾ ਵੀ ਰਿਆਜ਼ ਕਰਦਾ ਹਾਂ ਤੋ ਕਾਫ਼ੀ ਜਿੱਦਾਂ ਪੰਜਾਬੀ ਲੋਕ ਗਾਇਕ ਆ ਉਹਦੇ ਵਿੱਚ ਚਿਮਟਾ ਢੋਲ ਇਹ ਜਿਹੜੀਆਂ ਚੀਜ਼ਾਂ ਵਾ ਇਹ ਚੀਜ਼ਾਂ ਸਾਡੇ ਇਹਨਾਂ ਦੇ ਸਾਡੇ ਪੰਜਾਬੀਆਂ ਦੇ ਵਿੱਚ ਰਗ ਰਗ ਦੇ ਵਿੱਚ ਵਸੀਆਂ ਹੋਈਆਂ ਹਨ ਜਿਹੜਾ ਅਸਲੀ ਭੰਗੜਾ ਹੈ ਉਹ ਢੋਲ 'ਤੇ ਹੀ ਪੈਂਦਾ ਹੈ ਇਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਹਾਂ ਵੀ ਮੈਂ ਢੋਲ ਵੀ ਚੰਗੀ ਤਰ੍ਹਾਂ ਵਜਾਉਣਾ ਜਿਹੜਾ ਵਾ ਉਹ ਸਿੱਖ ਲਵਾਂ ਅਤੇ ਬਾਕੀ ਜਿਸ ਤਰ੍ਹਾਂ ਆਪਾਂ ਨੂੰ ਜਿਸ ਤਰ੍ਹਾਂ ਵੀ ਪ੍ਰੋਗਰਾਮ ਮਿਲਦਾ ਉਸ ਹਿਸਾਬ ਦੇ ਨਾਲ ਫਿਰ ਰਿਆਜ਼ ਦੀ ਤਿਆਰੀ ਕਰੀ ਦੀ ਜਿਸ ਤਰ੍ਹਾਂ ਕੱਲ੍ਹ ਕੋਈ ਪ੍ਰੋਗਰਾਮ 'ਤੇ ਜਾਣਾ ਹੋਵੇ ਜੇ ਧਾਰਮਿਕ ਹੋਵੇ ਉਹ ਧਾਰਮਿਕ ਰਿਆਜ਼ ਕੀਤਾ ਜਾਂਦਾ ਜੇ ਲੋਕ ਪੰਜਾਬੀ ਹੋਵੇ ਉਹਦੇ ਹਿਸਾਬ ਨਾਲ ਜਿਹੜਾ ਉਹ ਰਿਆਜ਼ ਕੀਤਾ ਜਾਂਦਾ